ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਭਜੀਤ ਕੌਰ ਬੋਲ ਰਹੀ ਹਾਂ ਮੈਂ ਤੁਹਾਡੀ ਟਰਾਂਸਪੋਰਟ ਤੋਂ ਅੰਮ੍ਰਿਤਸਰ ਤੋਂ ਦਿੱਲੀ ਲਈ ਇੱਕ ਕੈਬ ਬੁੱਕ ਕੀਤੀ ਸੀ ਮੈਂ ਤੁਹਾਡੇ ਨਾਲ ਉਸ ਦਿਨ ਕੈਬ ਬੁੱਕ ਕਰਨ ਦੇ ਪੈਸਿਆਂ ਲਈ ਜਦੋਂ ਗੱਲਬਾਤ ਕੀਤੀ ਸੀ ਤਾਂ ਆਪਣੇ ਦੋਨਾਂ ਵਿੱਚ ਕੈਬ ਦਾ ਕਿਰਾਇਆ ਤਿੰਨ ਹਜ਼ਾਰ ਰੁਪਏ ਤੈਅ ਹੋਇਆ ਸੀ ਨਾ ਕਿ ਤੇਤੀ ਸੌ ਪੰਜਾਹ ਰੁਪਏ ਹਾਂਜੀ ਪਰ ਭਾਅ ਜੀ ਤੁਹਾਡਾ ਡਰਾਈਵਰ ਮੇਰੇ ਕੋਲੋਂ ਤੇਤੀ ਸੌ ਪੰਜਾਹ ਮੰਗ ਰਹੇ ਨੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਭਾਅ ਜੀ ਨਾਲ ਮੇਰੀ ਗੱਲ ਤਿੰਨ ਹਜ਼ਾਰ ਪੰਜਾਹ ਵਿੱਚ ਹੋਈ ਹੈ ਤਾਂ ਉਹ ਕਹਿ ਰਹੇ ਨੇ ਭਾਅ ਜੀ ਦਾ ਮੈਨੂੰ ਪਤਾ ਨਹੀਂ ਮੇਰੇ ਤੇਤੀ ਸੌ ਪੰਜਾਹ ਰੁਪਏ ਬਣੇ ਹਨ ਉਹ ਇਹ ਵੀ ਕਹਿ ਰਹੇ ਹਨ ਕਿ ਰਸਤੇ ਵਿੱਚ ਪੰਜ ਟੋਲ ਆਉਂਦੇ ਹਨ ਅਤੇ ਉਹਨਾਂ ਨੇ ਉਸ ਦੇ ਪੈਸੇ ਵੀ ਮੈਂ ਦਿੱਤੇ ਨੇ ਅਤੇ ਇਸ ਹਿਸਾਬ ਨਾਲ ਮੇਰੇ ਤੇਤੀ ਸੌ ਪੰਜਾਹ ਰੁਪਏ ਹੋਏ ਨੇ ਅਤੇ ਤੁਸੀਂ ਇਹਨਾਂ ਨੂੰ ਕਹੋ ਕਿ ਪੈਸਿਆਂ ਦੀ ਜੋ ਆਪਣੀ ਗੱਲਬਾਤ ਹੋਈ ਹੈ ਉਨੇ ਹੀ ਪੈਸੇ ਲੈਣ ਹਾਂਜੀ ਇੱਕ ਗੱਲ ਹੋਰ ਇਹ ਨਾ ਬਹੁਤ ਤੇਜ਼ ਡਰਾਈਵ ਕਰਦੇ ਨੇ ਇਹਨਾਂ ਨੂੰ ਬਹੁਤ ਵਾਰ ਕਿਹਾ ਕਿ ਹੌਲੀ ਡਰਾਈਵਿੰਗ ਕਰੋ ਹੌਲੀ ਡਰਾਈਵਿੰਗ ਕਰੋ ਪਰ ਇਹਨਾਂ ਨੇ ਮੇਰੀ ਕੋਈ ਸੁਣੀ ਵੀ ਨਹੀਂ ਅਤੇ ਨਾ ਹੀ ਇਹਨਾਂ ਨੇ ਮੈਨੂੰ ਕੋਈ ਰਾਸ ਰਸਤੇ ਵਿੱਚ ਖਾਣਾ ਖਾਣ ਲਈ ਰੋਕਿਆ ਕਿਤੇ ਅਤੇ ਤੁਸੀਂ ਪਲੀਜ਼ ਇਹਨਾਂ ਨਾਲ ਸਮਝੌਤੇ ਵਾਲੀ ਗੱਲ ਕਰੋ ਅਤੇ ਜਿੰਨੀ ਤੁਹਾਡੇ ਨਾਲ ਮੇਰੀ ਪੇਮੈਂਟ ਦਾ ਹੋਇਆ ਹੈ ਉਹੀ ਤੁਸੀਂ ਇਹਨਾਂ ਕੋਲੋਂ ਕਹੋ ਕਿ ਹਾਂਜੀ ਮੇਰੇ ਕੋਲ ਉਨੇ ਹੀ ਪੈਸੇ ਲੈਣ ਮੈਂ ਤਿੰਨ ਹਜ਼ਾਰ ਪੰਜਾਹ ਤੋਂ ਇਲਾਵਾ ਇਕ ਰੁਪਿਆ ਵੀ ਐਕਸਟ੍ਰਾ ਨਹੀਂ ਦੇਣਾ ਹਾਂਜੀ ਥੈਂਕ ਯੂ